ਹੈਲੋ ਹਾਂਜੀ ਹਾਂਜੀ ਨਮਸਕਾਰ ਸਰ ਸਰ ਮੈਂ ਰਾਘਵ ਤਲਵਾੜ ਕਪੂਰਥਲਾ ਤੋਂ ਬੋਲ ਰਿਹਾ ਜੀ ਸਰ ਮੈਂ ਤੁਹਾਡੇ ਐਡਮਿਸ਼ਨ ਲੈਣੀ ਸੀ ਅਤੇ ਪਲੇਸਮੈਂਟ ਵਗੈਰਾ ਦਾ ਬਾਰੇ ਪਤਾ ਕਰਨਾ ਸੀਗਾ ਤੁਹਾਡੇ ਕਿ ਕਿੰਨੀਆਂ ਕੁ ਪਲੇਸਮੈਂਟਸ ਹੋਈਆਂ ਕਿਹੜੀ ਕਿਹੜੀ ਕੰਪਨੀਜ ਆਉਂਦੀਆਂ ਹਾਈਐਸਟ ਪੈਕਜ ਕਿੰਨਾ ਗਿਆ ਜੀ ਅੱਛਾ ਜੀ ਜੀ ਜੀ ਸਰ ਮੇਰੀ ਐੱਮ ਸੀ ਏ ਹੈਗੀ ਏ ਜੀ ਜੀ ਸਰ ਮੈਂ ਟੂ ਥਾਊਸੈਂਡ ਇਲੈਵਨ ਦੇ ਵਿੱਚ ਪਾਸ ਆਊਟ ਹਾਂ ਜੀ ਅਤੇ ਮੇਰੇ ਪ੍ਰੋਕਸੀਮੇਟ ਸੈਵਨਟੀ ਟੂ ਪ੍ਰਸੈਂਟ ਮਾਰਕਸ ਹੈਗੇ ਨੇ ਜੀ ਅੋਲ ਓਵਰ ਜੀ ਸਰ ਮੈਂ ਪੀ ਟੀ ਯੂ ਤੋਂ ਕੀਤੀ ਹੈ ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਤੋਂ ਜੀ ਸਰ ਸਰ ਨਹੀਂ ਮੈਂ ਫਰੈਸ਼ਰ ਹਾਂ ਜੀ ਜਸਟ ਹਜੇ ਪਾਸ ਆਊਟ ਹੀ ਹੋਇਆ ਬਾਕੀ ਥੋੜ੍ਹਾ ਅਬਰੋਡ ਗਿਆ ਹੋਇਆ ਸੀਗਾ ਅਤੇ ਉੱਥੋਂ ਜਸਟ ਵਾਪਸ ਹੀ ਆਇਆ ਜੀ ਉਹਦੇ 'ਚ ਵਰਕ ਐਕਸਪੀਰੀਅੰਸ ਨਹੀਂ ਹੈ ਕੋਈ ਵੀ ਸਰ ਅਗਰ ਵੈਬ ਡਿਵੈਲਪਮੈਂਟ ਦੇ ਜਾਂ ਤਾਂ ਹੋਸਟਿੰਗ ਜਾਂ ਨੈਟਵਰਕਸ ਮੈਨੇਜਮੈਂਟ ਹੋ ਗਿਆ ਜਿੱਦਾਂ ਨੈਟਵਰਕ ਐਡਮਿਨਿਸਟਰੇਟਰ ਵਗੈਰਾ ਹੋ ਗਿਆ ਕੁਛ ਇੱਦਾਂ ਦੀਆਂ ਓਪੋਰਚੁਨਿਟੀਜ ਹੈ ਤਾਂ ਮੈਂ ਈਜ਼ੀਲੀ ਹੈਂਡਲ ਕਰ ਪਾਵਾਂਗਾ ਮੇਰਾ ਐਕਚੁਲੀ ਇੰਟਰਸਟ ਵੀ ਇਹਦੇ ਵਿੱਚ ਹੀ ਹੈ ਜੀ

ਮੈਂ ਸਰ ਫਰੰਟ ਐਂਡ ਪਰੈਫਰ ਕਰਾਂਗਾ ਜੀ ਯੂਜਰ ਲਈ ਜੋ ਵੀ ਬੈਨੀਫਿਟ ਹੋ ਸਕਦਾ ਮੈਂ ਕਰ ਸਕਾਂਗਾ ਅੱਛਾ ਜੀ ਠੀਕ ਹੈ ਜੀ ਅਤੇ ਸਰ ਅਪਲਾਈ ਕਿੱਦਾਂ ਕਰਨਾ ਹੈ ਇਹਦੇ 'ਚ ਠੀਕ ਹੈ ਜੀ ਠੀਕ ਹੈ ਜੀ ਸਰ